ਮੈਂ ਵੀ ਆਰ ਪੰਜਾਬ ਤੋਂ ਕੁਝ ਖਾਸ ਦੁਕਾਨ ਤੋਂ ਸਮਾਨ ਖਰੀਦਿਆ ਜਿਸ ਦੇ ਲਈ ਮੈਨੂੰ ਇੱਕ ਕੁਛ ਖਾਸ ਕੂਪਨ ਪ੍ਰਾਪਤ ਹੋਏ ਜਿਸ ਵਿੱਚ ਅਗਲੇ ਸਮਾਨ ਖਰੀਦਣ 'ਤੇ ਉਸ ਦੀ ਛੋਟ ਨਿਰਧਾਰਤ ਕੀਤੀ ਗਈ ਜਿਸ ਦੇ ਲਈ ਮੈਨੂੰ ਕਾਫੀ ਫਾਇਦਾ ਵੀ ਹੋਵੇਗਾ